ਸਾਹਿਤ ਕਵਿਤਾ ਦੇ ਖੇਤਰ ਵਿੱਚ ਕੀ ਪੰਜਾਬੀ ਭਾਸ਼ਾ ਦੀ ਵਰਤੋਂ ਆ ਇਹ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਹੈਗੀ ਆ ਉਹ ਆਪਣੇ ਵਿਚਾਰਾਂ ਨੂੰ ਆਪਣੇ ਵਿਵਹਾਰ ਨੂੰ ਜਿਹੜੀ ਹੈ ਲਿਖਣ ਦੇ ਪ੍ਰਗਟਾਉ ਕਰਨ ਦੇ ਲਈ ਬੜੀ ਸਮੱਕਸ਼ਮ ਮਦੀ ਜਿਹੜੀ ਹੈਗੀ ਆ ਇਹ 'ਚ ਕੰਪੈਸਟੀ ਹੈ ਕਿਉਂਕਿ ਹਰ ਇੱਕ ਤਰ੍ਹਾਂ ਦੇ ਆਪਣੇ ਬਲਬਲੇ ਨੂੰ ਕਰ ਸਕਦੀ ਹੈ ਉਜਾਗਰ ਪ੍ਰਗਟਾ ਸਕਦਾ ਆਪਾਂ ਇਸ ਦੇ ਥਰੂ ਕਵਿਤਾ ਜੋ ਸਾਹਿਤ ਆ ਉਹਦੇ ਵਿੱਚ ਆਪਾਂ ਕਾਫੀ ਵਧੀਆ ਤਰੀਕੇ ਨਾਲ ਪੰਜਾਬੀ ਦੇ ਰੂਪ ਦੇ ਵਿੱਚ ਜਿਹੜੀ ਹੈਗੀ ਆ ਪੰਜਾਬੀ ਭਾਸ਼ਾ ਥਰੂ ਲਿਖ ਸਕਦੇ ਹਾਂ ਕਵਿਤਾ ਮੈਂ ਪੜ੍ਹੀ ਸੀ ਕਾਫੀ ਕਵਿਤਾਵਾਂ ਮੈਂ ਪੜ੍ਹਦਾ ਜਾਂ ਮੈਂ ਖੁਦ ਵੀ ਕਵਿਤਾਵਾਂ ਲਿਖਦਾ ਤਾਂ ਮੈਂ ਜ਼ਿਆਦਾਤਰ ਪੰਜਾਬੀ ਵਿੱਚ ਹੀ ਲਿਖਦਾ ਪੰਜਾਬੀ ਭਾਸ਼ਾ ਦੇ ਵਿੱਚ ਹੀ ਕਿਉਂਕਿ ਤੁਹਾਡੇ ਜੋ ਵਿਚਾਰ ਨੇ ਉਹਨਾਂ ਵਿਚਾਰਾਂ ਨੂੰ ਹੂ ਬ ਹੂ ਜਿਹੜਾ ਹੈ ਇਹ ਪ੍ਰਗਟਾ ਸਕਦੀ ਹੈ ਇਸ ਕਰਕੇ ਜਿਹੜੀ ਪੰਜਾਬੀ ਭਾਸ਼ਾ ਮੈਂ ਕਵਿਤਾ ਪੜ੍ਹੀ ਭਾਈ ਵੀਰ ਸਿੰਘ ਦੀ ਕਵਿਤਾ ਸੀ ਸਮਾਂ ਤਾਂ ਸਮੇਂ ਬਾਰੇ ਸੀ ਉਹ ਕਵਿਤਾ ਵੀ ਸਮਾਂ ਕਿਸ ਤਰੀਕੇ ਨਾਲ ਲੰਘ ਰਿਹਾ ਗਾ ਤਾਂ ਉਹ ਸਮ ਸਮੇਂ ਬਾਰੇ ਗੱਲ ਕਰ ਰਿਹਾ ਗਾ ਤਾਂ ਸਮੇਂ ਦਾ ਜਿਹੜਾ ਉਹ ਵਿਚਾਰ ਸੀ ਉਹਨਾਂ ਵਿਚਾਰ ਨੂੰ ਬੜਾ ਸੋਹਣੇ ਤਰੀਕੇ ਨਾਲ ਟਰੈਵਲ ਕਰਾਇਆ ਉਹਨਾਂ ਨੇ ਅਤੇ ਇਸ ਤਰੀਕੇ ਨਾਲ ਜਿਹੜੀ ਪੰਜਾਬੀ ਭਾਸ਼ਾ ਉਹ ਸਾਹਿਤ ਕਲਾ ਦੇ ਕਈ ਰੂਪਾਂ ਦੇ ਵਿੱਚ ਜਿਹੜੀ ਹੈਗੀ ਆ ਪ੍ਰਗਟਾ ਕਰਦੀ ਹੈ